ਸਤਿ ਸ੍ਰੀ ਅਕਾਲ ਜੀ ਮੈਂ ਕੁਝ ਸਮੇਂ ਪਹਿਲਾਂ ਆਨਲਾਈਨ ਇੱਕ ਗੀਜ਼ਰ ਆਰਡਰ ਕੀਤਾ ਸੀ ਉਸ ਗੀਜ਼ਰ 'ਤੇ ਕੰਪਨੀ ਵੱਲੋਂ ਦੋ ਸਾਲ ਦੀ ਵਾਰੰਟੀ ਦਿੱਤੀ ਗਈ ਸੀ ਪਰੰਤੂ ਜਦੋਂ ਉਸਨੂੰ ਘਰ ਲਗਾਇਆ ਗਿਆ ਤਾਂ ਕੁਝ ਸਮੇਂ ਬਾਅਦ ਹੀ ਉਸ ਵਿੱਚ ਦਿੱਕਤ ਆਉਣ ਲੱਗ ਪਈ ਉਹ ਸ਼ੋਰਟ ਸਰਕਿਟ ਹੋ ਗਿਆ ਜਿਸ ਕਾਰਨ ਪਾਣੀ ਵਿੱਚ ਵੀ ਕਰੰਟ ਆਉਣ ਲੱਗ ਪਿਆ ਪਰ ਜਦੋਂ ਇਸ ਦੀ ਕੰਪਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵਰੰਟੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਕਾਰਨ ਇਸ ਪ੍ਰੋਡਕਟ ਨੇ ਸਾਨੂੰ ਬਹੁਤ ਖ਼ਰਾਬ ਕੀਤਾ ਧੰਨਵਾਦ